ਮੈਨੂੰ ਨਿੱਕੀ ਹੁੰਦੀ ਤੋਂ ਹੀ ਫੋਟੋਗ੍ਰਾਫੀ ਦਾ ਬੜਾ ਸ਼ੌਂਕ ਸੀ ਅਸਲ ਵਿੱਚ ਜਦੋਂ ਮੇ ਮੈਂ ਅਤੇ ਛੁੱਟੀਆਂ ਵਿੱਚ ਮੇਰਾ ਪਰਿਵਾਰ ਹਰ ਵਾਰੀ ਅਸੀਂ ਕਿਤੇ ਨਾ ਕਿਤੇ ਘੁੰਮਣ ਜਾਂਦੇ ਸੀ ਤਾਂ ਮੈਂ ਉੱਥੇ ਫੋਟੋਆਂ ਖਿੱਚਦੀ ਸੀ ਬਹੁਤ ਸਾਰੀਆਂ ਇਸ ਆਪਣੀ ਯਾਦ ਤੌਰ 'ਤੇ ਮੈਨੂੰ ਅਸਲ ਵਿੱਚ ਮੈਨੂੰ ਨਿੱਕੀ ਹੁੰਦੀ ਤੋਂ ਹੀ ਫੋਟੋਆਂ ਖਿੱਚਣ ਦਾ ਇੰਨਾਂ ਕੁ ਸ਼ੌਂਕ ਸੀ ਕੀ ਮੈਂ ਆਪਣਾ ਕਰੀਅਰ ਜਿਹੜਾ ਹੈ ਉਹ ਫੋਟੋਗ੍ਰਾਫੀ ਵਿੱਚ ਹੀ ਵੇਖਿਆ ਸੀ ਮੈਂ ਚਾਹੁੰਦੀ ਸੀ ਕਿ ਮੇਰਾ ਕਰੀਅਰ ਫੋਟੋਗ੍ਰਾਫੀ ਵਿੱਚ ਹੀ ਬਣੇ ਮੈ ਵੱਡੇ ਵੱਡੇ ਲੋਕਾਂ ਦੀਆਂ ਫੋਟੋਆਂ ਖਿੱਚਾਂ ਮੈਨੂੰ ਫੋਟੋਗ੍ਰਾਫੀ ਵਿੱਚ ਮੈਂ ਸਕੂਲੇ ਵੀ ਕਦੇ ਕੋਈ ਕੰਪੀਟੀਸ਼ਨ ਹੁੰਦਾ ਤਾਂ ਫੋਟੋਗ੍ਰਾਫੀ ਦਾ ਵਗੈਰਾ ਮੈਂ ਉਹਦੇ ਵਿੱਚ ਜ਼ਰੂਰ ਪਾਟ ਲੈਂਦੀ ਅਤੇ ਜਿੱਤਦੀ ਵੀ ਸੀ ਅਸਲ ਵਿੱਚ ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਪਸੰਦ ਸੀ ਅਤੇ ਮੈਂ ਚਾਹੁੰਦੀ ਸੀ ਕਿ ਮੈਂ ਵੱਡੀ ਹੋ ਕੇ ਕਈ ਫੋਟੋਆਂ ਵੀ ਸ਼ੂਟ ਕਰਾਂ ਅਤੇ ਫੋ ਫਿਲਮਾਂ ਵੀ ਸ਼ੂਟ ਕਰਾਂ